ਇੱਕ ਦਿਨ ਸੋਮਵਾਰ ਦਾ ਦਿਨ ਸੀ ਅਤੇ ਸਾਰੀਆਂ ਬੱਸਾਂ ਭਰੀਆਂ ਹੋਈਆਂ ਆ ਰਹੀਆਂ ਸੀਗੀਆਂ ਅਤੇ ਮਤਲਬ ਕਿ ਮੈਂ ਬੱਸ ਲੈਣ ਲਈ ਕੋਲਜ ਜਾਣਾ ਸੀਗਾ ਅਤੇ ਮੈਂ ਬੱਸ ਲੈਣ ਲਈ ਖੜ੍ਹੀ ਸੀਗੀ ਅਤੇ ਸਾਰੀਆਂ ਬੱਸਾਂ ਨਾ ਬਹੁਤ ਜ਼ਿਆਦਾ ਭਰੀਆਂ ਆ ਸੀਗੀਆਂ ਕਿਉਂਕਿ ਸੋਮਵਾਰ ਮੰਗਲਵਾਰ ਨੂੰ ਨਾ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅਤੇ ਬੱਸ ਆਈ ਅਤੇ ਨਾ ਉਹ ਸਾਰੀ ਭਰੀ ਹੋਈ ਸੀਗੀ ਉਹ ਲਾਈਟਾਂ 'ਤੇ ਰੁਕੀ ਅਤੇ ਮੈਂ ਚੜ੍ਹ ਗਈ ਮਤਲਬ ਚੜ੍ਹੀ ਨਹੀਂ ਸੀ ਸੀਗੀ ਮੈਂ ਇੱਕ ਸਮ ਪੈਰ ਹੀ ਰੱਖਿਆ ਸੀ ਹਾਲੇ ਅਤੇ ਬੱਸ ਤੁਰ ਪਈ ਬੱਸ ਤੁਰਨ ਲੱਗੀ ਅਤੇ ਮੈਂ ਗਿਰ ਗਈ ਉਸ ਦਿਨ ਮੈਂ ਬਚ ਗਈ ਮਤਲਬ ਅਗਰ ਬੱਸ ਦਾ ਬਰੇਕ ਨਾ ਲੱਗਦਾ ਤਾਂ ਜਿਹੜਾ ਬੱਸ ਦਾ ਟਾਇਰ ਹੈ ਉਹ ਮੇਰੀ ਲੱਤ 'ਤੇ ਚੜ ਜਾਂਦਾ ਉਸ ਟਾਈਮ ਮਤਲਬ ਮੈਨੂੰ ਸੱਟਾਂ ਬਹੁਤ ਜ਼ਿਆਦੇ ਲੱਗੀਆਂ ਪਰ ਮੇਰਾ ਬਚਾਓ ਹੋ ਗਿਆ ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਵਾਂਗੀ ਕਿ ਮਤਲਬ ਤੁਸੀਂ ਚੱਲਦੀ ਬੱਸ ਵਿੱਚ ਨਾ ਚੜ੍ਹੋ ਮੇਰੇ ਵਾਲ਼ੀ ਗਲਤੀ ਕਦੇ ਨਾ ਕਰੋ ਕਿਉਂਕਿ ਤੁਹਾਡੀ ਜਾਨ ਬਹੁਤ ਜ਼ਿਆਦਾ ਕੀਮਤੀ ਹੈ ਸਾਰਿਆਂ ਦੀ ਜਾਨ ਆਪਣੀ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ ਅਤੇ ਸਾਨੂੰ ਇਸਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਆਪਣੀ ਜਾਨ ਨੂੰ ਮਤਲਬ ਕਦੇ ਵੀ ਜੋਖਮ 'ਚ ਨਹੀਂ ਅਸੀਂ ਪੰਜ ਮਿੰਟ ਲੇਟ ਪਹੁੰਚ ਜਾਵਾਂਗੇ ਬਟ ਸਾਨੂੰ ਆਪਣੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ ਔਰ ਬੱਸ ਰੁਕੇ 'ਤੇ ਹੀ ਚੜ੍ਹਨਾ ਚਾਹੀਦਾ ਹੈ ਚੱਲਦੀ ਬੱਸ ਵਿੱਚ ਨਹੀਂ ਚੜ੍ਹਨਾ ਚਾਹੀਦਾ ਸੋ ਜਿਹੜੀ ਗਲਤੀ ਮੈਂ ਕੀਤੀ ਹੈ ਉਹ ਤੁਸੀਂ ਕਦੇ ਵੀ ਭੁੱਲ ਕੇ ਨਹੀਂ ਕਰਨੀ